ਸਤਾਈ ਅਸਗਤ ਉੱਨੀ ਸੌ ਨੱਬੇ ਸੱਤ ਅਕਤੂਬਰ ਦੋ ਹਜ਼ਾਰ ਛੇ ਛੱਬੀ ਦਿਸੰਬਰ ਉੱਨੀ ਸੌ ਅੱਸੀ ਛੱਬੀ ਫਰਵਰੀ ਦੋ ਹਜ਼ਾਰ ਬਾਈ ਪੰਜ ਅਸਗਤ ਦੋ ਹਜ਼ਾਰ ਤੇਈ